ਹਾਂਜੀ ਮੈਂ ਦੋ ਦਿਨ ਪਹਿਲਾਂ ਨਾ ਆਨਲਾਈਨ ਇੱਕ ਲੈਪਟੋਪ ਮੰਗਵ ਮੰਗਵਾਇਆ ਸੀ ਅਤੇ ਉਹ ਲੈਪਟਾਪ ਦਾ ਜਿਹੜਾ ਮੇਰਾ ਤਜ਼ਰਬਾ ਰਿਹਾ ਉਹ ਬਹੁਤ ਜ਼ਿਆਦਾ ਖਰਾਬ ਰਿਹਾ ਸਭ ਤੋਂ ਪਹਿਲਾਂ ਤਾਂ ਡਿਲੀਵਰੀ ਨਹੀਂ ਉਹਦੀ ਜਿਹੜੀ ਸਮੇਂ ਸਿਰ ਹੋਈ ਬਹੁਤ ਦਿਨਾਂ ਬਾਅਦ ਮੈਨੂੰ ਉਹ ਲੈਪਟੋਪ ਮਿਲਿਆ ਫੇਰ ਜਿਹੜੀ ਉਹਦੀ ਪੈਕਿੰਗ ਸੀ ਉਹ ਬਹੁਤ ਵਾਹਿਯਾਤ ਸੀ ਮਤਲਬ ਪੈਕਿੰਗ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਕੋਈ ਵੀ ਉਹਨਾਂ ਦਾ ਪ੍ਰੋਟੈਕਟਰ ਨਹੀਂ ਸੀ ਉਹਦੇ ਵਿੱਚ ਕੋਈ ਲੱਗਿਆ ਹੋਇਆ ਸਿੱਧਾ ਹੀ ਮਤਲਬ ਇੱਕ ਖ ਖਾਲੀ ਡਿੱਬੇ ਦੇ ਵਿੱਚ ਪ੍ਰੋਡਕਟ ਆ ਜਿਹੜਾ ਉਹ ਪਾਇਆ ਹੋਇਆ ਸੀ ਅਤੇ ਸੀਲ ਵੀ ਨਹੀਂ ਸੀ ਉਹਦੀ ਚੰਗੀ ਤਰ੍ਹਾਂ ਡਿੱਬੇ ਦੇ ਉੱਪਰ ਅਤੇ ਲੈਪਟਾਪ ਜਦੋਂ ਮੈਂ ਕੱਢਿਆ ਉਹਦੇ ਵਿੱਚੋਂ ਤਾਂ ਸਿਲਵਰ ਕਲਰ ਦੇ ਲੈਪਟਾਪ ਦੇ ਉੱਤੇ ਪੂਰੀ ਦੀਆਂ ਪੂਰੀਆਂ ਜਿਹੜੀਆਂ ਸਕਰੈਚ ਪਏ ਹੋਏ ਸੀ ਅਤੇ ਫੇਰ ਲੈਪਟਾਪ ਮੈਂ ਚਲਾ ਕੇ ਵੇਖਿਆ ਚਲਾਉਣ ਤੋਂ ਬਾਅਦ ਮੈਂ ਬਸ ਘੰਟਾ ਕੁ ਉਹਨੂੰ ਚਾਰਜਿੰਗ ਵੀ ਦਿੱਤੀ ਹੈ ਅਤੇ ਪ੍ਰੋਪਰ ਚਾਰਜ ਵੀ ਨਹੀਂ ਹੋ ਰਿਹਾ ਸੀ ਉਹ ਅਤੇ ਨਾ ਹੀ ਉਹਦੀ ਸਕਰੀਨ ਹੈ ਜਿਹੜੀ ਉਸ ਤਰ੍ਹਾਂ ਕੰਮ ਕਰ ਰਹੀ ਸੀ ਜਿਵੇਂ ਕੰਮ ਕਰਦੀ ਹੈ ਮਤਲਬ ਲੋਡਿੰਗ ਹੀ ਲਈ ਜਾਂਦਾ ਪ੍ਰੋਸੈਸਿੰਗ ਹੀ ਉਹ ਲਈ ਲੈ ਰਿਹਾ ਸੀ ਹੈ ਨਾ ਅਤੇ ਇਹਦੇ ਨਾਲ ਹੀ ਮੈਂ ਚਾਰਜਰ ਵੀ ਵੇਖੇ ਚਾਰਜਰ ਦੀ ਹਾਲਤ ਵੀ ਖਸਤਾ ਸੀ ਅਤੇ ਪ੍ਰੋਪਰ ਚਾਰਜ ਜਦੋਂ ਪਹਿਲੀ ਵਾਰੀ ਲਾਉਂਦੇ ਤਾਂ ਪਹਿਲੀ ਵਾਰ ਲੱਗਦਾ ਵੀ ਨਹੀਂ ਸੀ ਉਹਨੂੰ ਮਤਲਬ ਹਿਲਾ ਜੁਲਾ ਕੇ ਲਾਉਣਾ ਪੈਂਦਾ ਸੀ ਸ਼ਾਇਦ ਉਹਦੀ ਕੋਈ ਪਿੰਨ ਪੁੰਨ ਦੀ ਵੀ ਸਮੱਸਿਆ ਸੀ ਚਾਰਜਰ ਦੇ ਵਿੱਚ ਅਤੇ ਉਸ ਤੋਂ ਬਾਅਦ ਲੈਪਟੋਪ ਦਾ ਜਿਹੜਾ ਫਲੈਪਰ ਆ ਉਹਦੇ ਵਿੱਚ ਵੀ ਮੈਨੂੰ ਇਹ ਦਿੱਕਤ ਲੱਗੀ ਇਹ ਲੱਗਿਆ ਵੀ ਉਹ ਜ਼ਿਆਦਾ ਲੂਜ਼ ਸੀ ਉਹ ਮਤਲਬ ਇਹ ਨਹੀਂ ਹੈ ਕਿ ਉਹ ਆਪਦੇ ਸਹਾਰੇ ਨਾਲ ਖੜ੍ਹ ਸਕਦਾ ਸੀ ਉਹ ਡਿੱਗ ਪੈਂਦਾ ਸੀ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਘਟੀਆ ਜਿਹੜਾ ਇਹਦਾ ਤਜ਼ਰਬਾ ਰਿਹਾ ਸ਼ਾਇਦ ਉਹ ਸੈਕਿੰਡ ਹੈਂਡ ਜਾਂ ਥਰਡ ਫੋਰ ਹੈਂਡ ਜਿਹੜੀ ਉਹ ਪ੍ਰੋਡਕਟ ਹੈ ਮੇਰੇ ਕੋਲ ਪਹੁੰਚਿਆ ਅਤੇ ਕੀਮਤ ਉਹਦੀ ਜਿਹੜੀ ਮੈਨੂੰ ਉਹ ਨਵੇਂ ਦੀ ਦੇਣੀ ਪਈ ਹੈ ਅਤੇ ਮੈਂ ਉਹ ਪ੍ਰੋਡਕਟ ਦੁਬਾਰਾ ਜਿਹੜਾ ਉਹ ਵਾਪਸ ਕਰਨਾ ਚਾਹੁੰਦਾ ਕਿਰਪਾ ਕਰਕੇ ਮੈਨੂੰ ਚੰਗੀ ਸਰਵਿਸ ਦਿੱਤੀ ਜਾਵੇ ਚੰਗਾ ਪ੍ਰੋਡਕਟ ਦਿੱਤਾ ਜਾਵੇ ਕਿਉਂਕਿ ਜਦੋਂ ਮੈਂ ਪੈਸਿਆਂ ਦੀ ਅਦਾਇਗੀ ਹੈ ਜਿਹੜੀ ਉਹ ਪੂਰਿਆਂ ਦੀ ਕੀਤੀ ਹੈ ਅਤੇ ਮੈਨੂੰ ਪੂਰੀ ਕੀਮਤ ਦੇ ਉੱਤੇ ਮੈਨੂੰ ਮੇਰਾ ਪ੍ਰੋਡਕਟ ਆ ਜਿਹੜਾ ਉਹ ਮੈਨੂੰ ਕਿਰਪਾ ਕਰਕੇ ਵਧੀਆ ਮਿਲਣਾ ਚਾਹੀਦਾ ਇਸ ਮਾੜੇ ਤਜ਼ਰਬੇ ਲਈ ਮੈਂ ਬਹੁਤ ਪਰੇਸ਼ਾਨ ਹੋਇਆਂ ਅਤੇ ਉਮੀਦ ਕਰਦਾ ਤੁਸੀਂ ਅੱਗੇ ਤੋਂ ਜਿਹੜਾ ਮੈਨੂੰ ਇਹ ਪ੍ਰੋਡਕਟ ਆ ਮੈਨੂੰ ਚੰਗਾ ਭੇਜੋਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ